ਪੰਜਾਬ ਵਿੱਚ ਬਹੁਤ ਵੱਡੇ ਮੂਵੀ ਥੇਟਰ ਜਾਂ ਮਲਟੀਪਲੈਕਸ ਹਨ ਜਿਵੇਂ ਕਿ ਵੀਆਰ ਪੰਜਾਬ ਖਰੜ ਵਿੱਚ ਅਤੇ ਪੀਵੀਆਰ ਐਲੈਂਟੇ ਮਾਲ ਜਿਸ ਵਿੱਚ ਬਹੁਤ ਵੱਡਾ ਫੂਡ ਕੋਰਟ ਹੈ ਅਤੇ ਉਸ ਵਿੱਚ ਅੱਠ ਸਕਰੀਨ ਲੱਗੇ ਹੋਏ ਹਨ ਜਿਵੇਂ ਕਿ ਕਾ ਕਾਰਨੇਵਲ ਸਿਨੇਮਾ ਜੋ ਕਿ ਜ਼ੀਰਕਪੁਰ ਵਿੱਚ ਹੈ ਉਸ ਦੇ ਵਿੱਚ ਰੈਕਿਨ ਰੈਕਲਿਨਰ ਤਿੰਨ ਸੌ ਵੀਹ ਅਤੇ ਪ੍ਰਾਈਮ ਦੇ ਵਿੱਚ ਇੱਕ ਸੌ ਅੱਸੀ ਰੁਪਏ ਅਤੇ ਕਲਾਸਿਕ ਵਿੱਚ ਇੱਕ ਸੌ ਸੱਠ ਰੁਪਏ ਦੀ ਟਿਕਟ ਹੈ ਨੀਲਨ ਸਿਨੇਮਾ ਚੰਡੀਗੜ੍ਹ ਵਿੱਚ ਇਹ ਬਹੁਤ ਪੁਰਾਣਾ ਹੈ ਅਤੇ ਇਸ ਵਿੱਚ ਤਿੰਨ ਸੌ ਸੀਟਾਂ ਹਨ ਅਤੇ ਸ਼ਹਿਰ ਦਾ ਸਭ ਤੋਂ ਵੱਡਾ ਸਿਨੇਮਾ ਹੈ ਪੀਵੀਆਰ ਸਿਨੇਮਾ ਫਿਰੋਜ਼ਪੁਰ ਵਿੱਚ ਹੈ ਅਤੇ ਇਹ ਬਾਰਾਂ ਵਜੇ ਖੁੱਲਦਾ ਹੈ ਅਤੇ ਇਸ ਦਾ ਖਾਣਾ ਬਹੁਤ ਮਹਿੰਗਾ ਹੈ ਸ਼ਿੰਗਾਰ ਸਿਨੇਮਾ ਜੋ ਉੱਤਰ ਭਾਰਤ ਵਿੱਚ ਬਹੁਤ ਵਧੀਆ ਹੈ ਅਤੇ ਲਕਸ਼ਮੀ ਪੈਲੇਸ ਜੋ ਕਿ ਲੁਧਿਆਣਾ ਲੁਧਿਆਣਾ ਗਰਾਊਂਡ ਰੋਡ ਵਿੱਚ ਹੈ ਇਹ ਵੀ ਬਹੁਤ ਵਧੀਆ ਹੈ ਹੀਨਾ ਸਿਨੇਮਾ ਇਹ ਆਗਾਰ ਨਗਰ ਮਲੇਰਕੋਟਲਾ ਟੂਡੀ ਸਿਨੇਮਾ ਚੱਲਦਾ ਹੈ ਅਤੇ ਇਸਦੇ ਪ੍ਰਾਈਮ ਦੇ ਵਿੱਚ ਦੋ ਦੋ ਸੌ ਵੀਹ ਰੁਪਏ ਅਤੇ ਕਲਾਸਿਕ ਦੇ ਇੱਕ ਸੌ ਨੱਬੇ ਰੁਪਏ ਹਨ